ਹੈਲੋ ਹਾਂਜੀ ਨਮਸਤੇ ਜੀ ਮੈਂ ਸੀਮਾ ਦੇਵੀ ਸੁਜਾਨਪੁਰ ਤੋਂ ਬੋਲਦੀ ਹਾਂ ਹਾਂਜੀ ਅੱਜ ਮੈਂ ਆਪਣੇ ਮਨਪਸੰਦ ਚੀਜ਼ ਦੇ ਬਾਰੇ ਤੁਹਾਨੂੰ ਦੱਸਦੀ ਹਾਂ ਕਿ ਮੈਨੂੰ ਤਾਂ ਹਰ ਚੀਜ਼ ਵੈਸੇ ਪਸੰਦ ਹੈ ਕਿ ਹਰ ਚੀਜ਼ ਖਾ ਲਈ ਖਾ ਲੈਂਦੇ ਹਾਂ ਜਿੱਦਾਂ ਕਿ ਅਸੀਂ ਮੈਂ ਬੜੇ ਸ਼ੌਕ ਨਾਲ ਆਲੂ ਮਟਰ ਬੜੇ ਖੁਸ਼ ਹੋ ਕੇ ਖਾਂਦੀ ਹਾਂ ਕਿ ਜਿੱਦਾਂ ਆਲੂ ਨੂੰ ਬਾਇਲ ਕਰਕੇ ਮਟਰ ਵਗੈਰਾ ਆਲੂ ਹਰੇ ਮਟਰ ਜੋ ਵੀ ਹੈ ਕਿ ਮੈਨੂੰ ਬੜੇ ਪਸੰਦ ਨੇ ਅਤੇ ਮੈਂ ਬੜੇ ਖੁਸ਼ ਹੋ ਕੇ ਖਾ ਲੈਂਦੀ ਹਾਂ ਅਤੇ ਮੈਂ ਤਕਰੀਬਨ ਹਫਤੇ ਬਾਅਦ ਬਣਾ ਹੀ ਲੈਂਦੀ ਹਾਂ ਕਿ ਮੈਨੂੰ ਜ਼ਿਆਦਾ ਪਸੰਦ ਹੈ ਕਿਉਂਕਿ ਹਰੀ ਚੀਜ਼ ਹਰੇ ਮਟਰ ਹੈ ਕਿ ਸਿਹਤ ਵਾਸਤੇ ਵੀ ਠੀਕ ਹੈ ਵਿਟਾਮਿਨ ਵੀ ਵਧੀਆ ਹੁੰਦੇ ਆ ਇਹਦੇ 'ਚ ਮਤਲਬ ਕਿ ਹਰੀਆਂ ਸਬਜ਼ੀਆਂ ਤੁਹਾਨੂੰ ਪਤਾ ਹੀ ਹੈ ਕਿ ਸਾਰੇ ਬੱਚੇ ਵੀ ਖੁਸ਼ ਹੋ ਕੇ ਖਾ ਲੈਂਦੇ ਹੈ ਔਰ ਕੀ ਜਿੱਦਾਂ ਗੋਭੀ ਹੋ ਗਈ ਗੋਭੀ ਮੈਨੂੰ ਬੜੀ ਪਸੰਦ ਹੈ ਅੱਜ ਕੱਲ੍ਹ ਭਿੰਡੀਆਂ ਅਤੇ ਉਹ ਵੀ ਹਰੀ ਸਬਜ਼ੀ ਹੈ ਅਤੇ ਉਹ ਵੀ ਮੈਨੂੰ ਬੜੀ ਪਸੰਦ ਆ ਅਤੇ ਉਹ ਵੀ ਮੈਂ ਖੁਸ਼ ਹੋ ਕੇ ਖਾ ਲੈਂਦੀ ਹਾਂ ਕਿ ਹਰੀਆਂ ਸਬਜ਼ੀਆਂ ਮੈਨੂੰ ਖਾਣਾ ਬੜਾ ਪਸੰਦ ਨੇ ਅਤੇ ਮੈਂ ਬੜੀ ਖੁਸ਼ ਹੋ ਕੇ ਖਾ ਲੈਂਦੀ ਹਾਂ ਕਿ ਜਿੱਦਾਂ ਮੇਥੀ ਹੋ ਗਈ ਪਾਲਕ ਹੋ ਗਿਆ ਸਰਸੋਂ ਦਾ ਸਾਗ ਹੋ ਗਿਆ ਪੰਜਾਬੀਆਂ ਦੀ ਫੇਵਰੇਟ ਡਿਸ਼ ਜਿਹੜੀ ਕਿ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਕਿ ਮੈਂ ਖੁਸ਼ ਹੋ ਕੇ ਖਾ ਲੈਂਦੀ ਹਾਂ ਅਤੇ ਇੱਦਾਂ ਕਿ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਇਹ ਚੀਜ਼ਾਂ ਖੁਸ਼ ਹੋ ਕੇ ਖਾਣੀਆਂ ਚਾਹੀਦੀਆਂ ਨੇ ਕਿ ਚੰਗੀਆਂ ਨੇ ਹਰੀਆਂ ਚੀਜ਼ਾਂ ਖਾਣ ਦੇ ਬਹੁਤ ਫਾਇਦੇ ਹਨ ਇਸ ਦੱਸਦੇ ਆ ਕਿ ਹਰੀਆਂ ਸਬਜ਼ੀਆਂ 'ਚ ਬਹੁਤ ਜ਼ਿਆਦਾ ਵਿਟਾਮਿਨ ਮਿਲਦੇ ਹਨ ਅਤੇ ਤੁਸੀਂ ਵੀ ਜ਼ਿਆਦਾ ਤੋਂ ਜ਼ਿਆਦਾ ਹਰੀਆਂ ਸਬਜ਼ੀਆਂ ਖਾਣ ਦੀ ਕੋਸ਼ਿਸ਼ ਕਰੋ ਕਿ ਅਸੀਂ ਤਾਂ ਬਹੁਤ ਜ਼ਿਆਦਾ ਖੁਸ਼ ਹੋ ਕੇ ਇਹਨਾਂ ਨੂੰ ਖਾ ਲੈਂਦੇ ਹਾਂ